ਮੈਨੂੰ ਸ਼ੁਰੂ ਤੋਂ ਹੀ ਕਲੇ ਡਿਜ਼ਾਈਨਿੰਗ ਕਰਨੀ ਬਹੁਤ ਪਸੰਦ ਸੀਗੀ ਮੈਂ ਸਕੂਲ ਵਿੱਚ ਹਮੇਸ਼ਾ ਹੀ ਡਿਜ਼ਾਈਨ ਡਰਾਇੰਗ ਦੇ ਹੀ ਸਬਜੈਕਟ ਨੂੰ ਚੁਣਦੀ ਹੁੰਦੀ ਸੀਗੀ ਔਰ ਮੈਨੂੰ ਡਰਾਇੰਗ ਕਰਨੀ ਬਹੁਤ ਵਧੀਆ ਲੱਗਦੀ ਸੀਗੀ ਮੈਨੂੰ ਜਦੋਂ ਫਰੀ ਟਾਈਮ ਮਿਲਦਾ ਮੈਂ ਹਮੇਸ਼ਾ ਡਰਾਇੰਗ ਕਰਦੀ ਅਤੇ ਕਲਰਿੰਗ ਕਰਦੀ ਔਰ ਹਮੇਸ਼ਾ ਹੀ ਮੈਂ ਪਹਿਲੇ ਨੰਬਰ 'ਤੇ ਹੁੰਦੀ ਫੇਰ ਅੱਗੇ ਜਾ ਕੇ ਕਾਲਜ ਵਿੱਚ ਵੀ ਮੈਂ ਡਿਜ਼ਾਈਨਿੰਗ ਦਾ ਹੀ ਡਿਪਲੋਮਾ ਕੀਤਾ ਜਿਸ ਵਿੱਚ ਮੈਨੂੰ ਟੈਕਸਟਾਈਲ ਡਿਜ਼ਾਈਨਿੰਗ ਕਰਨੀ ਬਹੁਤ ਵਧੀਆ ਲੱਗਦੀ ਸੀਗੀ ਮੈਨੂੰ ਹਮੇਸ਼ਾ ਨੈਚਰਲ ਡਿਜ਼ਾਈਨਿੰਗ ਕਰਨੀ ਵਧੀਆ ਲੱਗਦੀ ਸੀਗੀ ਮੈਂ ਹਮੇਸ਼ਾ ਖੁਦ ਆਪਣੇ ਆਪ ਹੀ ਡਿਜ਼ਾਈਨਿੰਗ ਕਰਦੀ ਅਤੇ ਉਹਨਾਂ ਦੇ ਬਣਾਉਂਦੀ ਮੈਨੂੰ ਆਰਟੀਫਿਸ਼ਅਲ ਡਿਜ਼ਾਇਨਿੰਗ ਜਾਂ ਕਿਸੇ ਦੀ ਕੋਪੀ ਕਰਨੀ ਵਧੀਆ ਨਹੀਂ ਲੱਗਦੀ ਸੀਗੀ ਮੈਂ ਹਮੇਸ਼ਾ ਖੁਦ ਡਿਜ਼ਾਈਨ ਤਿਆਰ ਕਰਦੀ ਸੀਗੀ ਔਰ ਜੋ ਕਿ ਮੇਰੇ ਸਾਰੇ ਟੀਚਰਸ ਨੂੰ ਬਹੁਤ ਹੀ ਪਸੰਦ ਆਉਂਦੇ ਅਤੇ ਉਹਨਾਂ ਦੇ ਸਕੈਚਿਸ ਬਣਵਾਏ ਜਾਂਦੇ ਸੀਗੇ ਮੈਨੂੰ ਫਰੀ ਹੈਂਡ ਪੇਂਟਿੰਗ ਕਰਨੀ ਬਹੁਤ ਵਧੀਆ ਲੱਗਦੀ ਸੀਗੀ